ਚੌਦਾਂ ਫਰਵਰੀ ਦੋ ਹਜ਼ਾਰ ਦੋ ਨੌ ਸਤੰਬਰ ਦੋ ਹਜ਼ਾਰ ਦੋ ਸਤਾਈ ਅਗਸਤ ਦੋ ਹਜ਼ਾਰ ਵੀਹ ਉੱਨੀ ਜੂਨ ਉੱਨੀ ਸੌ ਉਣਾਨਵੇਂ ਚੌਵੀ ਅਗਸਤ ਉੱਨੀ ਸੌ ਉਣਾਨਵੇਂ